ਹੋਰ ਰਮਨ ਕਿਵੇਂ ਆ ਹਾਂ ਠੀਕ ਹੋਰ ਘਰ ਕਿਵੇਂ ਹਾਂ ਹਾਂ ਇੱਧਰ ਵੀ ਠੀਕ ਠਾਕ ਹੋਰ ਜਵਾਕ ਜਾਂਦੇ ਹੁੰਦੇ ਸਕੂਲ

ਕੋਈ ਨਵੀਂ ਤਾਜ਼ੀ ਠੀਕ ਠੀਕ

ਓ ਯਾਰ ਮੇਰਾ ਇੱਕ ਸਰਟੀਫਿਕੇਟ ਜਿਹਾ ਰਹਿੰਦਾ ਸੀ ਮੈਰਜ ਮੈਰਜ ਸਰਟੀਫਿਕੇਟ ਭਡੀ ਜੀ ਲੋਕਰ 'ਚ ਹਾਂ ਅਪਲੋਡ ਕਰਨਾ ਸੀ ਹਾਂ ਹਾਂ ਬਾਕੀ ਤਾਂ ਸਾਰੇ ਹੋਏ ਹੋਏ ਆ ਹਾਂ ਹਾਂ ਇਹੀ ਰਹਿੰਦਾ ਇੱਕ

ਅੱਛਾ ਨਹੀਂ ਉਹ ਅਪਲੋਡ ਕਰਨਾ ਕਦੋਂ ਵਿਹਲਾ ਨਹੀਂ ਅੱਜ ਤਾਂ ਮੈਨੂੰ ਕੰਮ ਆ

ਕੱਲ੍ਹ ਨੂੰ ਮਿਲੀਏ

ਕਿੰਨੇ ਕੁ ਵਜੇ ਫਰੀ ਹੋਏਗਾ ਦਸ ਗਿਆਰਾਂ ਕੁ ਵਜੇ ਚਲ ਠੀਕ ਚਲ ਕੱਲ੍ਹ ਨੂੰ ਮਿਲਦੇ ਗਿਆਰਾਂ ਕੁ ਵਜੇ ਆਹ ਵੀ ਕਰਾ ਦਈਏ ਯਾਰ